ਜੀ ਹਾਂ ਜੇਕਰ ਉਸ ਰੈਸਟੋਰੈਂਟ ਦਾ ਭੋਜਨ ਅੱਛਾ ਹੋਏਗਾ ਵਧੀਆ ਕੁਆਲਿਟੀ ਦਾ ਹੋਏਗਾ ਤਾਂ ਅਸੀਂ ਜ਼ਰੂਰ ਉਸ ਭੋਜਨ ਦਾ ਆਨੰਦ ਮਾਣ ਸਕਦੇ ਕਿਉਂਕਿ ਜ਼ਿਆਦਾਤਰ ਕਾਂਟੇ ਛੁਰੀ 'ਤੇ ਭੋਜਨ ਡਿਪੈਂਡ ਨਹੀਂ ਕਰਦਾ ਜਿਵੇਂ ਕਿ ਆਪਾਂ ਲੰਗਰਾਂ ਵਿੱਚ ਹੀ ਦੇਖ ਲੈਂਦੇ ਹਾਂ ਲੋਕ ਪੱਤਨ 'ਤੇ ਵੀ ਉਸ ਭੋਜਨ ਦਾ ਸਵਾਦ ਲੈ ਸਕਦੇ ਹਨ ਕਿਉਂਕਿ ਉਹ ਭੋਜਨ ਦੀ ਅੰਦਰ ਕੋਈ ਖ਼ਾਸੀਅਤ ਕੋਈ ਗੁਣ ਵੀ ਹੋਣਾ ਚਾਹੀਦਾ ਆ ਜ਼ਰੂਰੀ ਨਹੀਂ ਇਹ ਕਾਂਟੇ ਛੂਰੀ 'ਤੇ ਹੀ ਡਿਪੈਂਡ ਕਰਦਾ ਆ ਅਕਸਰ ਅਸੀਂ ਰੈਸਟੋਰੈਂਟ ਵਿੱਚ ਜਾਂਦੇ ਹਾਂ ਜੋ ਜ਼ਿਆਦਾ ਹਾਈ ਸਟੈਂਡਰਡ ਲੋਕ ਹੁੰਦੇ ਹਨ ਉਹ ਜ਼ਿਆਦਾਤਰ ਇਸ ਤਰ੍ਹਾਂ ਨਾਲ ਹੀ ਖਾਣਾ ਪਸੰਦ ਕਰਦੇ ਹਨ ਜਿਵੇਂ ਕਿ ਕਾਂਟਾ ਛੁਰੀ ਆਦਿ ਚਮਚਿਆਂ ਨਾਲ ਲੇਕਿਨ ਜੋ ਲੋਕ ਪੜ੍ਹੇ ਲਿਖੇ ਵਧੀਆ ਮਾਇੰਡ ਲੈਗੁਏਜ ਹੁੰਦੇ ਹਨ ਤਾਂ ਉਹ ਕਿਸੇ ਵੀ ਤਰ੍ਹਾਂ ਨਾਲ ਖਾਣਾ ਪਸੰਦ ਕਰ ਸਕਦੇ ਹਨ ਧੰਨਵਾਦ